ਹਾਂ ਮੇਰੇ ਕੋਲ ਕਿਤਾਬਾਂ ਹਨ ਜੋ ਮੈਨੂੰ ਬਹੁਤ ਸੱਚੀਆਂ ਲੱਗਦੀਆਂ ਨੇ ਅਤੇ ਜੋ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਹਨ ਮੇਰੇ ਕੋਲ ਅੰਮ੍ਰਿਤਾ ਪ੍ਰੀਤਮ ਦਾ ਇੱਕ ਨੋਵਲ ਹੈ ਇੱਕ ਸੀ ਅਨੀਤਾ ਜੋ ਬਿਲਕੁਲ ਸੱਚੀ ਘਟਨਾ 'ਤੇ ਅਧਾਰਿਤ ਹੈ ਔਰ ਇੱਕ ਔਰਤ ਦੀ ਜ਼ਿੰਦਗੀ ਨੂੰ ਪੇਸ਼ ਕਰਦਾ ਹੈ ਦੂਸਰਾ ਮੇਰੇ ਕੋਲ ਦਲੀਪ ਕੌਰ ਟਿਵਾਣਾ ਮੇਰੇ ਪੰਸ਼ ਨੋਵਲ ਮੌਜੂਦ ਹਨ ਉਹਦੇ ਪੰਜੋ ਦੇ ਪੰਜੋ ਨੋਵਲ ਇੱਕ ਔਰਤ ਦੀ ਜ਼ਿੰਦਗੀ ਨੂੰ ਪੇਸ਼ ਕਰਦੇ ਹਨ ਔਰ ਮੈਨੂੰ ਹਮੇਸ਼ਾ ਉਹ ਕਿਤਾਬਾਂ ਬਹੁਤ ਚੰਗੀਆਂ ਲੱਗਦੀਆਂ ਹਨ ਜੋ ਔਰਤ ਦੀ ਜ਼ਿੰਦਗੀ ਨੂੰ ਦੀ ਹਕੀਕਤ ਨੂੰ ਪੇਸ਼ ਕਰਦੀਆਂ ਹਨ